ਹਾਂ ਰੇਡੀਓ ਸ਼ਟੇਸ਼ਨ 'ਤੇ ਮੈਨੂੰ ਬਹੁਤ ਸਾਰੇ ਪ੍ਰੋਗਰਾਮ ਪਸੰਦ ਹਨ ਪਰ ਉਹਨਾਂ ਵਿੱਚੋਂ ਇੱਕ ਸੰਜੀਵ ਕਪੂਰ ਸ਼ੈਫ ਦਾ ਪ੍ਰੋਗਰਾਮ ਮੈਨੂੰ ਬਹੁਤ ਪਸੰਦ ਹੈ ਕਿਉਂਕਿ ਉਸ ਵਿੱਚ ਮੈਨੂੰ ਨਵੀਆਂ ਨਵੀਆਂ ਚੀਜ਼ਾਂ ਬਣਾਉਣ ਦਾ ਪਤਾ ਲੱਗਦਾ ਹੈ